ਹਾਂਜੀ ਹੁਣ ਦੇਖੋ ਜਿਸ ਤਰ੍ਹਾਂ ਕਿ ਪਟਿਆਲਾ ਜ਼ਿਲ੍ਹਾ ਹੈ ਪਹਿਲਾਂ ਤਾਂ ਇੱਥੇ ਜੇ ਕੋਈ ਇਨਸਾਨ ਬਾਹਰੋਂ ਆਉਂਦਾ ਸੀ ਤਾਂ ਉਹਨੂੰ ਕਿਰਾਏ 'ਤੇ ਮਕਾਨ ਲੈਣ ਦੇ ਵਿੱਚ ਬੜੀ ਦਿੱਕਤ ਆਉਂਦੀ ਸੀ ਪਰ ਹੁਣ ਜਿਸ ਤਰ੍ਹਾਂ ਕਿ ਅਸੀਂ ਸਲਾਰੀਆ ਵਿਹਾਰ ਕਲੋਨੀ ਦੇ ਵਿੱਚ ਰਹਿੰਦੇ ਹਾਂ ਉੱਥੇ ਇਹ ਦੇਖਿਆ ਜਾਂਦਾ ਕਿ ਜੇ ਲੋਕ ਆਪ ਜ਼ਮੀਨੀ ਮੰਜ਼ਿਲ 'ਤੇ ਰਹਿੰਦੇ ਹਨ ਤਾਂ ਉਹਨਾਂ ਨੇ ਪਹਿਲੀ ਮੰਜ਼ਿਲ ਜੋ ਬਣਾਈ ਹੋਈ ਹੈ ਉੱਥੇ ਕਿਰਾਏਦਾਰਾਂ ਨੂੰ ਰੱਖਣਾ ਕਾਫੀ ਚੰਗਾ ਸਮਝਦੇ ਹੈ ਤਕਰੀਬਨ ਸਾਰੇ ਲੋਕਾਂ ਨੇ ਹੀ ਆਪਣੀ ਪਹਿਲੀ ਮੰਜ਼ਿਲ 'ਤੇ ਕਿਰਾਏ ਕਿਰਾਏ ਦੇ ਲਈ ਘਰ ਦਿੱਤੇ ਹੋਏ ਹੈ ਇੱਕ ਹੋਰ ਪਟਿਆਲਾ ਜ਼ਿਲ੍ਹਾ ਦੇ ਵਿੱਚ ਜਿਸ ਤਰ੍ਹਾਂ ਸਰਹੰਦ ਰੋਡ 'ਤੇ ਆਪਾਂ ਜਾਂਦੇ ਹਾਂ ਉੱਥੇ ਇੱਕ ਕਲੋਨੀ ਬਣੀ ਹੋਈ ਹੈ ਗਾਰਡਨ ਹਾਈਟਸ ਉੱਥੇ ਫਲੈਟ ਬਣੇ ਹੋਏ ਹੈ ਤਕਰੀਬਨ ਪੰਦਰਾਂ ਮੰਜ਼ਿਲਾਂ ਹਨ ਅਤੇ ਇੱਕ ਇੱਕ ਬਲੋਕ ਦੇ ਵਿੱਚ ਕੋਈ ਸੱਠ ਫਲੈਟ ਹੈ ਫਲੈਟ ਨੇ ਅਤੇ ਉਹ ਫਲੈਟ ਦਾ ਕਿਰਾਇਆ ਮੈਨੂੰ ਲੱਗਦਾ ਕਿ ਕੋਈ ਸੱਤ ਕੁ ਹਜ਼ਾਰ ਰੁਪਏ ਮਹੀਨੇ ਦੇ ਵਿੱਚ ਤੁਹਾਨੂੰ ਮਿਲ ਜਾਂਦਾ ਅਤੇ ਜੇ ਆਪਾਂ ਸਲਾਰੀਆ ਵਿਹਾਰ ਦੀ ਗੱਲ ਕਰੀਏ ਇੱਥੇ ਕਿਰਾਇਆ ਪੰਜ ਕੁ ਹਜ਼ਾਰ ਹੈ ਇੱਕ ਮੰਜ਼ਿਲ ਨੂੰ ਲੈਣ ਦਾ ਇਹ ਜੋ ਸਲਾਰੀਆ ਵਿਹਾਰ ਦੇ ਮਕਾਨ ਹਨ ਇਹ ਤਕਰੀਬਨ ਕੁੜੀਆਂ ਵਿਦਿਆਰਥਣਾਂ ਨੂੰ ਦਿੱਤੇ ਜਾਂਦੇ ਹਨ ਜਾਂ ਫਿਰ ਪੂਰੀ ਫੈਮਿਲੀ ਨੂੰ ਦਿੱਤੇ ਜਾਂਦੇ ਹਨ ਅਤੇ ਜੋ ਫਲੈਟ ਨੇ ਗਾਰਡਨ ਹਾਈਟਸ ਵਾਲੇ ਉਹ ਕੋਈ ਵੀ ਲੈ ਸਕਦਾ ਹੈ ਕਿਰਾਇਆ ਸੱਤ ਕੁ ਹਜ਼ਾਰ ਦੇ ਕਰੀਬ ਹੈ